ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਹਾਡੇ ਰੈਸਟੋਰੈਂਟ ਬਾਰੇ ਪਤਾ ਚੱਲਿਆ ਅਸੀਂ ਪਹਿਲਾਂ ਲੋਕਲ ਹੀ ਸਵੀਗੀ ਵਗੈਰਾ 'ਤੇ ਜਾਂ ਜਮੈਟੋ ਵਗੈਰਾ 'ਤੇ ਭੋਜਨ ਕਰਦੇ ਸੀ ਅਤੇ ਇਹ ਜਾਣ ਕੇ ਬੜੀ ਖੁਸ਼ੀ ਹੋਈ ਸੰ ਸਾਨੂੰ ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਡੇ ਕੋਲ ਕੋਈ ਮਸਾਲੇਦਾਰ ਜਾਂ ਮਿੱਠਾ ਪਕਵਾਨ ਹੈ ਮਿੱਠੇ ਪਕਵਾਨ ਦੇ ਵਿੱਚ ਤੁਹਾਡੇ ਕੋਲ ਕੀ ਕੀ ਆਈਟਮਾਂ ਹਨ ਵਿਸ਼ੇਸ਼ ਤੌਰ 'ਤੇ ਜਿਵੇਂ ਅਸੀਂ ਲੱਡੂ ਜਲੇਬੀ ਰਸਗੁੱਲਾ ਅਤੇ ਆਦਿ ਖਾਣ ਦੇ ਸ਼ੌਕੀਨ ਜੇ ਤੁਹਾਡੇ ਕੋਲ ਵਧੀਆ ਕੜਕਦਾਰ ਕੋਈ ਜਲੇਬੀ ਵੀ ਹੈ ਤਾਂ ਕਿਰਪਾ ਕਰਕੇ ਉਹ ਤੁਸੀਂ ਦੋ ਸੌ ਗ੍ਰਾਮ ਜਲੇਬੀ ਦਾ ਜਿਹੜਾ ਸਾਡਾ ਆਰਡਰ ਹੈ ਉਹ ਕਬੂਲ ਕਰੋ ਅਤੇ ਦਿਓ ਹਾਂ ਉਸ ਤੋਂ ਬਾਅਦ ਇਹ ਹੈ ਵੀ ਮਸਾਲੇਦਾਰ ਕੋਈ ਆਈਟਮ ਤੁਹਾਡੇ ਕੋਲ ਹੈ ਖਾਸ ਵਿਸ਼ੇਸ਼ ਤੌਰ 'ਤੇ ਸਬਜ਼ੀ ਦੇ ਵਿੱਚ ਕੋਈ ਤਾਂ ਉਹ ਮਸਾਲੇਦਾਰ ਐਟਮ ਬਾਰੇ ਵੀ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਸਾਡੀ ਇੱਛਾ ਦੇ ਵਿੱਚ ਜਿਹੜੀ ਸਾਡਾ ਪਸੰਦੀਦਾ ਭੋਜਨ ਆ ਮਸਾਲੇਦਾਰ ਦੇ ਵਿੱਚ ਉਹ ਇਹ ਆ ਵੀ ਜੇ ਗੁਵਾਰੇ ਦੀਆਂ ਫਲੀਆਂ ਤੁਹਾਡੇ ਕੋਲ ਹੈ ਅਤੇ ਜਾਂ ਭਿੰਡੀ ਹੈ ਤੁਹਾਡੇ ਕੋਲ ਅਤੇ ਇਸ ਤੋਂ ਬਿਨਾ ਘੀਏ ਦੀ ਸਬਜ਼ੀ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਇਹਨਾਂ ਦੇ ਵਿੱਚੋਂ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਭਿੰਡੀ ਦੀ ਸਬਜ਼ੀ ਹੈ ਜਿਹੜੀ ਉਹ ਜ਼ਰੂਰ ਦਿਓ ਅਤੇ ਇਹ ਆਰਡਰ ਸਾਨੂੰ ਕਿਰਪਾ ਕਰਕੇ ਜਲਦੀ ਕਰ ਦਿਓ ਅਤੇ ਮਿਹਰਬਾਨੀ ਜੀ